ਟੈਕਨੋਲੋਜੀ ਨੇ ਸਾਡੇ ਖੇਤਰ ਵਿੱਚ ਭਾਈਚਾਰੇ ਵਿੱਚ ਬਹੁਤ ਏਕਤਾ ਵਧਾਈ ਹੈ ਟੈਕਨੋਲੋਜੀ ਵਿੱਚ ਵਟਸਅੱਪ ਰਾਹੀਂ ਜਾਂ ਟਵੀਟਰ ਸਨੈਪਚੈਟ ਅਤੇ ਇਹਨਾਂ ਚੀਜ਼ਾਂ ਰਾਹੀਂ ਅਸੀਂ ਆਪਣੇ ਦੂਰ ਬੈਠੇ ਰਿਸ਼ਤੇਦਾਰਾਂ ਨਾਲ ਵੀਡੀਓ ਕੋਲ 'ਤੇ ਕੋਲ 'ਤੇ ਆਪਾਂ ਗੱਲ ਕਰ ਸਕਦੇ ਹਾਂ ਵੀਡੀਓ ਕੋਲ 'ਤੇ ਅਸੀਂ ਉਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਮਹਿਸੂਸ ਕਰ ਸਕਦੇ ਹਾਂ ਜਿਵੇਂ ਸਾਡੇ ਕੋਲ ਬੈਠੇ ਵਿਅਕਤੀ ਨਾਲ ਅਸੀਂ ਆਪਾਂ ਗੱਲ ਕਰ ਸਕਦੇ ਹਾਂ ਟੈਕਨੋਲੋਜੀ ਨੂੰ ਨੇ ਸਾਨੂੰ ਬਹੁਤ ਚੀਜ਼ਾਂ ਦੇ ਵਿੱਚ ਬਹੁਤ ਚੀਜ਼ਾਂ ਵਿੱਚ ਹੀ ਸਹਾਇਤਾ ਕੀਤੀ ਹੈ ਅਤੇ ਸਾਨੂੰ ਸਾਡੇ ਰਿਸ਼ਤੇਦਾਰਾਂ ਨਾਲ ਜੋੜਨ ਵਿੱਚ ਵੀ ਸਾਡੀ ਸਹਾਇਤਾ ਕੀਤੀ ਹੈ ਅਸੀਂ ਟੈਕਨੋਲਜੀ ਰਾਹੀਂ ਉਹਨਾਂ ਨਾਲ ਜੁੜੇ ਰਹਿੰਦੇ ਹਾਂ ਵਟਸਪਅਪ ਇੰਸਟਾ ਫੇਸਬੁੱਕ ਵਗੈਰਾ ਤੋਂ ਹੀ ਅਸੀਂ ਆਪਣੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਆਪਣੇ ਚਹੇਤਿਆਂ ਨੂੰ ਦੇਖ ਸਕਦੇ ਹਾਂ ਅਤੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਦੇਖ ਸਕਦੇ ਹਾਂ ਪਰ ਇਸ ਦੇ ਨਾਲ ਨਾਲ ਕੁਛ ਲੋਕ ਅਜਿਹੇ ਵੀ ਹਨ ਜਿਵੇਂ ਜੋ ਇਸ ਟੈਕਨੋਲੋਜੀ ਦਾ ਗਲਤ ਇਸਤੇਮਾਲ ਵੀ ਕਰਦੇ ਹਨ ਸਾਡੀ ਹੀ ਰਿਸ਼ਤੇਦਾਰੀ ਵਿੱਚ ਸਾਡੇ ਐਮ ਐਲ ਏ ਪੂਜਾ ਲੂਥਰਾ ਲਈ ਕੁਝ ਲੋਕਾਂ ਨੇ ਉਹਨਾਂ ਨੂੰ ਗਲਤ ਵਿਚਾਰਾਂ ਨਾਲ ਸੰਬੋਧਿਤ ਕੀਤਾ ਜਿਸ ਨਾਲ ਉਹਨਾਂ ਦੇ ਦਿਲ 'ਤੇ ਬਹੁਤ ਗਹਿਰੀ ਠੇਸ ਪਹੁੰਚੀ ਹਾਲਾਂਕਿ ਉਹ ਗਲਤ ਨਹੀਂ ਸਨ ਪਰ ਲੋਕਾਂ ਨੇ ਉਹਨਾਂ ਨੂੰ ਗਲਤ ਵਿਚਾਰਾਂ ਨਾਲ ਬੋਲਿਆ ਜਿਹਨਾਂ ਕਰਕੇ ਉਹਨਾਂ ਦੇ ਉਹਨਾਂ ਨੂੰ ਬਹੁਤ ਮਹਿਸੂਸ ਹੋਇਆ ਅਤੇ ਉਹ ਬਹੁਤ ਜ਼ਿਆਦਾ ਲੋ ਫੀਲ ਕਰ ਰਹੇ ਸਨ ਟੈਕਨੋਲਜੀ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਟੋਰਚਰ ਕੀਤਾ ਇਸ ਲਈ ਸ਼ੋਸ਼ਲ ਮੀਡੀਆ 'ਤੇ ਉਹਨਾਂ ਬਾਰੇ ਗਲਤ ਵਿਚਾਰ ਗ ਪ੍ਰਗਟ ਕੀਤੇ ਅਤੇ ਉਹ ਇਹਨਾਂ ਕਰਕੇ ਹੁਣ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਸੋਸ਼ਲ ਮੀਡੀਆ ਜਾਂ ਬਾਹਰ ਆਉਣ ਲੱਗਿਆਂ ਇਸ ਕਰਕੇ ਇਹਨਾਂ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ ਬਸ ਉਹਨਾਂ ਚੀਜ਼ਾਂ ਲਈ ਹੀ ਵਰਤਿਆ ਜਾਏ ਜਿਹਨਾਂ ਚੀਜ਼ਾਂ ਲਈ ਇਹਨਾਂ ਨੂੰ ਬਣਾਇਆ ਗਿਆ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਨਾ ਕੀਤਾ ਜਾਵੇ